ਜੀ ਹਾਂ ਮੈਨੂੰ ਵੀ ਰਾਜਨੀਤੀ ਅਤੇ ਰਾਜ ਅਤੇ ਭਲਾਈ ਬਾਰੇ ਖ਼ਬਰਾਂ ਵਿੱਚ ਦਿਲਚਸਪੀ ਹੈ ਦਿਲਚਸਪੀ ਇਸ ਕਰਕੇ ਹੈ ਕਿਉਂਕੀ ਆਪਾਂ ਆਹ ਪ੍ਰਤੱਖ ਤੌਰ 'ਤੇ ਆਪਾਂ ਭਾਰਤ ਨਾਲ ਜੁੜੇ ਹੋਏ ਹਾਂ ਇੱਕ ਨਾਗਰਿਕ ਹਾਂ ਅਤੇ ਨਾਗਰਿਕਤਾ ਜਿਹੜੀ ਉਹ ਰਾਜਨੀਤੀ ਦੇ ਅਧਾਰ 'ਤੇ ਹੀ ਪੂਰੀ ਹੋ ਸਕਦੀ ਹੈ ਮੌਜੂਦਾ ਜਿਹੜੇ ਅਫੇਅਰ ਦੀਆਂ ਖ਼ਬਰਾਂ ਉਹਨੂੰ ਕਈ ਵਾਰ ਤਾਂ ਇਹੋ ਜਿਹਾ ਹੁੰਦਾ ਵੀ ਅਸੀਂ ਜੋ ਖ਼ਬਰਾਂ ਦੇਖਦੇ ਹਾਂ ਉਹ ਜ਼ਿਆਦਾਤਰ ਖ਼ਬਰਾਂ ਤਾਂ ਫੇਕ ਹੁੰਦੀਆਂ ਕਹਿੰਦੇ ਕਈ ਇਲੈਕਸ਼ਨ ਤੋਂ ਪਹਿਲਾਂ ਤਾਂ ਰਾਜ ਜਿਹੜੇ ਨੇਤਾ ਹੁੰਦੇ ਹੈ ਉਹ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕਰਦੇ ਹੈ ਪਰ ਜੇ ਉਹਨਾਂ ਦੀ ਉਹ ਗਰਾਊਂਡ ਲੈਵਲ ਦੀ ਉਹ ਗੱਲਾਂ ਨੂੰ ਦੇਖਿਆਂ ਜਾਏ ਤਾਂ ਰਿਆਲਿਟੀ ਵਿੱਚ ਜਾਂ ਸਚਾਈ ਵਿੱਚ ਅਜਿਹਾ ਕੁਛ ਨਹੀਂ ਹੋਇਆ ਹੁੰਦਾ ਹਰ ਨੇਤਾ ਨੂੰ ਜਦੋਂ ਕੁਰਸੀ ਮਿਲ ਜਾਂਦੀ ਹੈ ਤਾਂ ਉਹ ਸਿਰਫ ਆਪਣੇ ਉਹਦਾ ਉਹ ਸਵਾਰਥੀਪਣ ਜਿਹੜਾ ਉਹ ਪਹਿਲਾਂ ਆ ਜਾਂਦਾ ਜਨਤਾ ਪਿੱਛੇ ਰਹਿ ਜਾਂਦੀ ਹੈ ਜਦਕਿ ਜਨਤਾ ਨੇ ਬਹੁਤ ਕੁਛ ਸੋਚ ਕੇ ਬਹੁਤ ਕੁਛ ਆਪਣੇ ਭਵਿੱਖ ਬਾਰੇ ਸੋਚ ਕੇ ਹੀ ਉਸ ਨੇਤਾ ਨੂੰ ਵੋਟ ਪਾਈ ਹੁੰਦੀ ਹੈ ਅਤੇ ਬਹੁਤ ਸਾਰੀਆਂ ਇਹੋ ਜਿਹੀਆਂ ਖ਼ਬਰਾਂ ਹਨ ਹੁੰਦੀਆਂ ਹਨ ਜਿਹੜੀਆਂ ਫੇਕ ਹੁੰਦੀਆਂ ਹਨ ਔਰ ਮੀਡੀਆ ਦੀ ਵੀ ਕਈ ਇਹੋ ਜਿਹੇ ਸੋਰਸ ਹੁੰਦੇ ਹਨ ਜੋ ਬਸ ਵਿਊਜ਼ ਲੈਣ ਦੇ ਕਰਕੇ ਕੀ ਹੈ ਫੇਕ ਖ਼ਬਰਾਂ ਛਾਪਦੇ ਹਨ ਜਿਹਦੇ ਤੋਂ ਆਪਾਂ ਨੂੰ ਪੂਰੀ ਤਰ੍ਹਾਂ ਨਾਲ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਇਹੋ ਅਜਿਹੀ ਖ਼ਬਰ ਸਾਡੇ ਜੀਵਨ ਵਿੱਚ ਨੁਕਸਾਨ ਪਹੁੰਚਾ ਸਕਦੀ ਹੈ ਰਾਜਨੀਤੀ ਅਤੇ ਰਾਜ ਦੀ ਭਲਾਈ ਬਾਰੇ ਸਾਨੂੰ ਖ਼ਬਰਾਂ 'ਚ ਬਹੁਤ ਦਿਲਚਸਪੀ ਹੈ ਕਿਉਂ ਕਿਉਂਕੀ ਜੇ ਸਾਨੂੰ ਪਤਾ ਹੀ ਨਹੀਂ ਲੱਗੇਗਾ ਵੀ ਸਰਕਾਰ ਸਾਡੇ ਲਈ ਕੀ ਕਰ ਰਹੀ ਹੈ ਅਤੇ ਅਸੀਂ ਉਹਦਾ ਫਾਇਦਾ ਜਿਹੜਾ ਹੁਣ ਉਦੋਂ ਤੱਕ ਨਹੀਂ ਉਠਾ ਸਕਦੇ ਇਸ ਕਰਕੇ ਇਹਨਾਂ ਚੀਜ਼ਾਂ ਦੀ ਖ਼ਬਰ ਜਿਹੜੀ ਹੈ ਉਹਦੀ ਸਾਨੂੰ ਪੂਰੀ ਤਰ੍ਹਾਂ ਨਾਲ ਉਹਦੇ ਵਿੱਚ ਦਿਲਚਸਪੀ ਦਿਖਾਉਣੀ ਪੈਂਦੀ ਹੈ ਤਾਂ ਕੀ ਸਾਡਾ ਸਰਬਪੱਖੀ ਵਿਕਾਸ ਹੋ ਸਕੇ ਅਸੀਂ ਵੀ ਆਪਦੀ ਸਰਕਾਰ ਤੋਂ ਕੋਈ ਫਾਇਦਾ ਲੈ ਸਕੀਏ